ਅੱਜ ਕੱਲ੍ਹ ਤਾਂ ਸਪੋਰਟਸ ਇੱਕ ਬਹੁਤ ਹੀ ਵੱਡਾ ਐਨਟਨਟੈਨਮੇਂਟ ਦਾ ਬਣ ਚੁੱਕਿਆ ਸੋਰਸ ਅੱਜ ਕੱਲ੍ਹ ਹਰ ਇੱਕ ਸਪੋਟ ਨੂੰ ਲੋਕ ਜ਼ਿਆਦਾ ਮਜ਼ੇ ਵਾਸਤੇ ਦੇਖਦੇ ਹਨ ਲੋਕੀ ਸਮਝਦੇ ਹਨ ਕਿ ਸਪੋਰਟਸ ਨੂੰ ਮਜ਼ੇ ਨਾਲ ਦੇਖੋ ਅਤੇ ਖੁਸ਼ ਰਹੋ ਪਰ ਆਹ ਗੱਲ ਸਹੀ ਵੀ ਹਨ ਜਿਹੜੇ ਲੋਕ ਬੁੱਢੇ ਹੋ ਚੁਕੇ ਹਨ ਉਸ ਮਜ਼ੇ ਵਾਸਤੇ ਦੇਖਦੇ ਹਨ ਜਿਸ ਤਰ੍ਹਾ ਅੱਜ ਕੱਲ੍ਹ ਭਾਰਤ ਦੇ ਵਿੱਚ ਆਈ ਪੀ ਐਲ ਜਿਹੜਾ ਕ੍ਰਿਕਟ ਦਾ ਟੂਰਨਾਮੈਂਟ ਹੈ ਉਹ ਇੰਨਾ ਜ਼ਿਆਦਾ ਮਸ਼ਹੂਰ ਹੈ ਕਿ ਲੋਕ ਤਾਂ ਲੱਖਾਂ ਵਿੱਚ ਪੈਸਾ ਵਹਾ ਦਿੰਦੇ ਹਨ ਉਹ ਟੂਰਨਾਮੈਂਟ ਦੀ ਟਿਕਟ ਲੈਣ 'ਚ ਅਤੇ ਉਹਨੂੰ ਵੀ ਆਈ ਪੀ ਵਿੱਚ ਦੇਖਣ ਵਾਸਤੇ ਲੋਕ ਤਾਂ ਉਹ ਟੂਰਨਾਮੈਂਟ ਨੂੰ ਕਿੰਨੀ ਦੂਰੋਂ ਦੂਰੋਂ ਆਣ ਕੇ ਵੀ ਦੇਖਦੇ ਹਨ ਲੋਕ ਤਾਂ ਮਜ਼ੇ ਵਾਸਤੇ ਦੇਖਦੇ ਹਨ ਅਤੇ ਖੁਸ਼ ਰਹਿੰਦੇ ਹਨ ਲੋਕ ਉਹ ਟੂਰਨਾਮੈਂਟ ਇੱਦਾਂ ਦਾ ਟੂਰਨਾਮੈਂਟ ਹੈ ਜਿਸ ਨੇ ਪੂਰੇ ਭਾਰਤ ਦੇਸ਼ ਵਿਚ ਰਿਕਾਰਡ ਬਣਾਏ ਹਨ ਅਤੇ ਆਪਣੇ ਹੀ ਰਿਕਾਰਡਾਂ ਨੂੰ ਤੋੜ ਕੇ ਨਵੇਂ ਰਿਕਾਰਡ ਬਣਾਏ ਹਨ ਲੋਕ ਤਾਂ ਖੁਸ਼ ਰਹਿੰਦੇ ਹਨ ਉਹ ਦੇਖ ਕੇ ਅਤੇ ਨਾਲ ਉਹ ਟੂਰਨਾਮੈਂਟ ਦੀ ਵੀ ਹੋਰ ਤਰੱਕੀ ਹੋਈ ਜਾਂਦੀ ਹੈ ਅਤੇ ਟੂਰਨਾਮੈਂਟ ਬਾਹਰਲੇ ਦੇਸ਼ਾ ਵਿੱਚ ਵੀ ਬੜਾ ਜ਼ਿਆਦਾ ਮਸ਼ਹੂਰ ਬਣੀ ਜਾ ਰਿਹਾ ਹੈ